ਹਾਂਜੀ ਤੁਸੀਂ ਸ਼ਰਮਾ ਟੈਲੀਕੋਮ ਤੋਂ ਬੋਲ ਰਹੇ ਹੋ ਅੱਛਾ ਜੀ ਅਸੀਂ ਨਾ ਤੁਹਾਡੇ ਫੋਨ ਲੈ ਕੇ ਗਏ ਸੀ ਤੇ ਉਹ ਨਾ ਤਾਂ ਨਾ ਹੁਣ ਚਾਰਜਿੰਗ ਹੁੰਦਾ ਹੈਗਾ ਤੇ ਨਾ ਹੀ ਹੁਣ ਚਾਰਜਿੰਗ ਉਹ ਲੱਗਦਾ ਹੈਗਾ ਹਾਂ ਤੇ ਦਸ ਕਿ ਦਿਨ ਪਹਿਲਾਂ ਲੈ ਗਏ ਸੀ ਤੇ ਹੁਣ ਕਿਵੇਂ ਕਰਨਾ ਉਹਦਾ ਤੁਸੀਂ ਚੇਂਜ ਕਰੋਗੇ ਚਾਰਜਰ ਚੇਂਜ ਕਰੋਗੇ ਜਾ ਵੀ ਫੋਨ ਨੂੰ ਦੁਬਾਰਾ ਉਹ ਕਰੋਗੇ ਹੂ ਅੱਛਾ ਠੀਕ ਹੈ ਹੂੰ ਹੁੰ ਹੁਣ ਵੀ ਬਿਲਕੁਲ ਕੰਮ ਨਹੀਂ ਕਰਦਾ ਹੈਗਾ ਹੁੰ ਚਾਰਜਿੰਗ ਵਾਲੀ ਛੇਤੀ ਖਤਮ ਹੋ ਜਾਂਦੀ ਹੈ ਉਹਦੀ ਹੁੰ ਨਹੀਂ ਗੱਲ ਸੁਣ ਕੇ ਤੁਸੀਂ ਨਾ ਸਪੀਕਰਾਂ ਤੇ ਕੋਈ ਨੁਕਸ ਹੈਗਾ ਸਹੀ ਸਮਝ ਨਹੀਂ ਆਉਂਦੀ ਉਹਨਾਂ ਦੀ ਹੁੰ ਹੁਣ ਮੇਰੇ ਹਿਸਾਬ ਨਾਲ ਸਰ ਮੇਰੇ ਬਿਲ ਤਾਂ ਮੇਰੇ ਕੋਲ ਸਾਰੇ ਪਏ ਆ ਤੁਹਾਡੇ ਹਾਂ ਸਭ ਕੁਝ ਸਾਂਭ ਕੇ ਰੱਖ ਸਕੇ ਹਾਂ ਤੇ ਸਾਰਾ ਕੁਝ ਨਾਲ ਲੈ ਆਈਏ ਅੱਛਾ ਠੀਕ ਹੈ ਨਾ ਜੇ ਵੀ ਉਹਦੇ ਸਰਵਿਸ ਕਰਕੇ ਠੀਕ ਹੁੰਦਾ ਹੈ ਤਾਂ ਸਰਵਿਸ ਕਰਦੇਓ ਜੇ ਚੇਂਜ ਕਰ ਤਾਂ ਚੇਂਜ ਕਰ ਦੇਓ ਹੁੰ

ਠੀਕ ਹੈ ਜੀ ਠੀਕ ਹੈ ਚਲੋ ਜੀ ਧੰਨਵਾਦ